ਪ੍ਰਿੰਟ ਮੀਡੀਆ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਅਖਬਾਰ ਰਸਾਲੇ ਕਿਤਾਬਾਂ ਫਲਾਈਅਰ ਅਤੇ ਪ੍ਰਿੰਟ ਕੀਤੇ ਸੰਚਾਰ ਦੇ ਹੋਰ ਰੂਪ ਸ਼ਾਮਿਲ ਹੁੰਦੇ ਹਨ ਰਸਾਲੇ ਇੱਕ ਕਿਸਮ ਦਾ ਪ੍ਰਿੰਟ ਮੀਡੀਆ ਹੁੰਦਾ ਹੈ ਜੋ ਆਮ ਤੌਰ 'ਤੇ ਸਮੇਂ ਸਮੇਂ 'ਤੇ ਪ੍ਰਕਾਸ਼ਿਤ ਹੁੰਦਾ ਹੈ ਅਤੇ ਇਸ ਵਿੱਚ ਵੱਖ ਵੱਖ ਵਿਸ਼ਿਆਂ 'ਤੇ ਲੇਖ ਫੋਟੋਆਂ ਅਤੇ ਇਸ਼ਤਿਹਾਰ ਹੁੰਦੇ ਹਨ ਇਹ ਵੀ ਮੀਡੀਆ ਜਾਂ ਆਡੀਓ ਵਿਜ਼ੂਅਲ ਮੀਡੀਆ ਸੰਸਾਰ ਦੇ ਉਹ ਰੂਪ ਹਨ ਜੋ ਅਵਾਜ਼ ਅਤੇ ਚਿੱਤਰਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਟੈਲੀਵਿਜ਼ਨ ਰੇਡੀਓ ਫਿਲਮ ਅਤੇ ਵੀਡੀਓ ਗੇਮਾਂ ਜਾਣਕਾਰੀ ਉਹ ਡੇਟਾ ਜਾਂ ਤੱਥ ਹੈ ਜੋ ਕਿਸੇ ਵੀ ਮਾਧਿਅਮ ਰਾਹੀਂ ਸੰਚਾਰਿਤ ਜਾਂ ਪ੍ਰਚਾਰਿਤ ਕੀਤੇ ਜਾਂਦੇ ਹਨ ਮੀਡੀਆ ਮੀਡੀਆ ਦਾ ਇੱਕ ਬੋਲੜਾ ਸ਼ਬਦ ਹੈ ਜਿਸਦਾ ਕੋਈ ਅਰਥ ਨਹੀਂ ਕਿਉਂਕਿ ਇਸ ਦਾ ਕੋਈ ਵੀ ਮੂਲ ਰੂਪ ਨਹੀਂ ਹੁੰਦਾ ਜਾਣਕਾਰੀ ਦੇ ਵੱਖ ਵੱਖ ਸਰੋਤਾਂ ਵਿੱਚ ਕਿਸ 'ਤੇ ਸਭ ਤੋਂ ਵੱਧ ਭਰੋਸਾ ਕਰਨਾ ਹੈ ਇਹ ਫੈਸਲਾ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਉਹਨਾਂ ਦੇ ਭਰੋਸੇਯੋਗਤਾ ਸ਼ੁੱਧਤਾ ਅਤੇ ਪੱਖਪਾਤ ਦਾ ਮੁਲਾਂਕਣ ਕਾਰਨਾ ਹੁੰਦਾ ਹੈ ਭਰੋਸੇਯੋਗਤਾ ਸਰੋਤ ਦੀ ਪ੍ਰਤਿਸ਼ਠਤਾ ਅਤੇ ਯੋਗਤਾਵਾਂ ਨੂੰ ਦਰਸਾਉਂਦੀ ਹੈ ਸ਼ੁੱਧਤਾ ਦਾ ਮਤਲਬ ਹੈ ਜਾਣਕਾਰੀ ਕਿੰਨੀ ਚੰਗੀ ਤਰ੍ਹਾਂ ਅਸਲੀਅਤ ਨੂੰ ਦਰਸਾਉਂਦੀ ਹੈ ਅਤੇ ਸਬੂਤ ਦੁਆਰਾ ਸਮਰਥਿਤ ਹੈ ਪੱਖਪਾਤ ਦਾ ਮਤਲਬ ਹੈ ਕਿ ਜਾਣਕਾਰੀ ਸਰੋਤ ਦੇ ਵਿਚਾਰਾਂ ਦ੍ਰਿਸ਼ਟੀਕੋਣਾਂ ਅਤੇ ਏਜੰਡੇ ਤੋਂ ਕਿੰਨੀ ਪ੍ਰਭਾਵਿਤ ਹੈ ਇਹ ਭਰੋਸੇਯੋਗ ਸਰੋਤ ਭਰੋਸੇਯੋਗ ਸਹੀ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਜਾਂ ਘੱਟੋ ਘੱਟ ਉਹਨਾਂ 'ਤੇ ਸੰਭਾਵੀ ਪੱਖਪਾਤ ਦਾ ਖੁਲਾਸਾ ਕਰਨਾ ਚਾਹੀਦਾ ਹੈ ਧੰਨਵਾਦ